ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਆ ਅਤੇ ਜਿਵੇਂ ਕਿ ਮੈਂ ਇੱਕ ਪੜ੍ਹਿਆ ਲਿਖਿਆ ਸਿੱਖਿਅਤ ਇਨਸਾਨ ਹਾਂ ਅਤੇ ਇਸ ਕਰਕੇ ਹੀ ਇਹ ਮੇਰੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਮੇਰਾ ਹਰ ਪਾਸੇ ਸਾਥ ਦਿੰਦਾ ਹੈ ਹਰ ਤਰ੍ਹਾਂ ਮਦਦ ਕਰਦਾ ਹੈ ਕਿ ਸਿੱਖਿਅਤ ਇਨਸਾਨ ਹੀ ਪੂਰੀ ਦੁਨੀਆ ਵਿੱਚ ਵਿਚਰ ਸਕਦਾ ਹੈ ਜੋ ਲੋਕ ਪੜ੍ਹ ਨਹੀਂ ਪਾਉਂਦੇ ਜਾਂ ਅਨਪੜ੍ਹ ਰਹਿ ਜਾਂਦੇ ਹਨ ਉਹਨਾਂ ਨੂੰ ਕਈ ਤਰ੍ਹਾਂ ਦੇ ਮੁਸੀਬਤ ਨਾ ਪੈਂਦਾ ਹੈ ਲੋਕ ਉਹਨਾਂ ਨੂੰ ਹਰ ਤਰ੍ਹਾਂ ਟਿੱਚਰਾਂ ਕਰਦੇ ਹਨ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ ਕਿ ਤੁਸੀਂ ਅਨਪੜ੍ਹ ਹੋ ਤੁਸੀਂ ਪੜ੍ਹੇ ਲਿਖੇ ਨਹੀਂ ਅਤੇ ਅਸੀਂ ਸਿੱਖਿਅਤ ਹਾਂ ਅਸੀਂ ਪੜ੍ਹੇ ਲਿਖੇ ਹਾਂ ਤੁਸੀਂ ਲੋਕਾਂ ਦੇ ਹਾਜ਼ ਅੱਗੇ ਹਾਜ਼ਰ ਜਵਾਬ ਹੋਵਾਂਗੇ ਅਤੇ ਸਾਨੂੰ ਉਹਨਾਂ ਦੀ ਹਰ ਗੱਲ ਦਾ ਜਵਾਬ ਦੇ ਸਕਦੇ ਹਾਂ ਅਤੇ ਇਸ ਕਰਕੇ ਸਾਡੇ ਫਰਜ਼ ਵੀ ਬਣਦਾ ਹੈ ਜੋ ਪੜ੍ਹ ਨਹੀਂ ਪਏ ਹਨ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ ਉਹ ਬੇਚਾਰੇ ਆਪਣੀ ਕਿਸੇ ਮਜ਼ਬੂਰੀ ਕਰਕੇ ਪੜ੍ਹ ਨਹੀਂ ਪਾਏ ਅਤੇ ਸਾਥ ਦੇਣਾ ਚਾਹੀਦਾ ਉਹਨਾਂ ਦਾ ਕਦੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਅਤੇ ਅਨਪੜ੍ਹ ਹੋਣ ਦੇ ਹੋਰ ਵੀ ਕਈ ਨੁਕਸਾਨ ਹੋ ਸਕਦੇ ਹਨ ਜਿਵੇਂ ਕਿ ਅਸੀਂ ਕੋਈ ਸਾਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੇਗੀ ਸਾਨੂੰ ਕੋਈ ਲੋਕ ਪਸੰਦ ਨਹੀਂ ਕਰਨਗੇ ਸਾਡੇ ਘਰ ਦੇ ਸਾਡੇ ਤੋਂ ਦੁਖੀ ਰਹਿਣਗੇ ਇਸ ਲਈ ਸਾਨੂੰ ਸਿੱਖਿਅਤ ਹੋਣਾ ਚਾਹੀਦਾ ਹੈ ਸਾਨੂੰ ਸਿੱਖਿਅਤ ਹੋ ਕੇ ਮਦਦ ਕਰਨੀ ਚਾਹੀਦੀ ਹੈ ਲੋਕਾਂ ਦੀ ਸਿੱਖਿਅਤ ਹੋ ਕੇ ਜਿਸ ਸਿੱਖਿਅਤ ਤੁਸੀਂ ਹਰ ਤਰ੍ਹਾਂ ਦੇ ਮੁਸ਼ਕਲ 'ਚੋਂ ਨਿਕਲਦਾ ਮੇਨ ਨਿਕਲਣ ਦਾ ਆਪਾਂ ਰਸਤਾ ਲੱਭ ਸਕਦੇ ਹਾਂ ਧੰਨਵਾਦ